ਹਾਂਜੀ ਮੈਂ ਇੱਕ ਪੇਂਟਿੰਗ ਬਣਾਈ ਸੀ ਅਤੇ ਜਿਸ ਨੂੰ ਮੈਂ ਇੱਕ ਸਿਰਫ਼ ਪੇਂਟਿੰਗ ਦੀ ਤਰ੍ਹਾਂ ਬਣਾਇਆ ਸੀ ਜੋ ਕਿ ਮੈਂ ਇੰਟਰਨੈੱਟ ਉੱਤੇ ਦੇਖੀ ਸੀ ਅਤੇ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ ਅਤੇ ਮੈਂ ਇਸਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਮੇਰੇ ਲਈ ਸਿਰਫ਼ ਇਹ ਇੱਕ ਪੇਂਟਿੰਗ ਸੀ ਜੋ ਕਿ ਜਿਸਨੂੰ ਮੈਂ ਬਣਾਉਣ ਵਿੱਚ ਸਫ਼ਲ ਰਹੀ ਪਰ ਜਦੋਂ ਮੈਂ ਇਸਨੂੰ ਆਪਣੇ ਸਮੇਂ ਦੇ ਇਸ ਨੂੰ ਬਣਾਉਣ ਤੋਂ ਬਾਅਦ ਫੁਰਸਤ ਦੇ ਦੌਰਾਨ ਚੰਗੀ ਤਰ੍ਹਾਂ ਦੇਖਿਆ ਤਾਂ ਮੈਨੂੰ ਇੱਕ ਡੂੰਘਾ ਅਰਥ ਮਹਿਸੂਸ ਹੋਇਆ ਮੇਰੇ ਲਈ ਸਿਰਫ਼ ਇਹ ਇੱਕ ਫੁੱਲਾਂ ਦੀ ਪੇਂਟਿੰਗ ਸੀ ਜੋ ਕਿ ਇੱਕ ਪਲੇਟ ਦੇ ਉੱਪਰ ਬਣਾਈ ਗਈ ਸੀ ਪਰ ਜਦੋਂ ਮੈਂ ਇਸਨੂੰ ਦੇਖਿਆ ਤਾਂ ਇਹ ਫੁੱਲ ਨਹੀਂ ਸਨ ਇਹ ਉਹ ਭੁੱਖੇ ਲੋਕ ਸਨ ਜੋ ਕਿ ਖਾਣੇ ਲਈ ਤਰਸ ਰਹੇ ਸਨ ਅਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਸਨ ਕਿ ਉਹ ਖਾਣੇ ਨੂੰ ਬਰਬਾਦ ਨਾ ਕਰਨ ਅਤੇ ਇਸ ਤੋਂ ਬਾਅਦ ਮੈਂ ਇਹ ਫੈਸਲਾ ਕੀਤਾ ਕਿ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਇਨਸਾਨ ਮਿਲੇਗਾ ਤਾਂ ਉਸਨੂੰ ਮੈਂ ਕੁਝ ਨਾ ਕੁਝ ਸਿਖਾਵਾਂਗੀ